ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੈਂ ਪਿਛਲੇ ਹਫਤੇ ਆਪ ਜੀ ਦੇ ਐਪ ਦੇ ਸੰਬੰਧਿਤ ਕੁਛ ਸਮਾਨ ਔਡਰ ਕੀਤਾ ਸੀ ਜਿਵੇਂ ਕਿ ਘਰ ਦਾ ਕੁਛ ਸਮਾਨ ਝਾੜੂ ਅਤੇ ਪੋਚਾ ਕੁਛ ਘਰ ਸੌਦਿਆਂ ਦਾ ਸਮਾਨ ਵੀ ਸੀ ਕੁਛ ਆਪਣਾ ਜ਼ਰੂਰੀ ਸਮਾਨ ਹੋਰ ਘਰ ਦਾ ਸਮਾਨ ਔਡਰ ਕੀਤਾ ਸੀ ਲੇਕਿਨ ਉਹ ਮੈਂ ਕੁਛ ਜ਼ਰੂਰੀ ਕਾਰਨਾਂ ਕਰਕੇ ਨਹੀਂ ਪ੍ਰਾਪਤ ਕਰਨਾ ਚਾਹੁੰਦੀ ਸੀ ਅਤੇ ਇਸ ਲਈ ਮੈਂ ਆਪ ਜੀ ਦੇ ਅੱਗੇ ਬੇਨਤੀ ਵੀ ਕੀਤੀ ਸੀ ਕਿ ਉਹ ਮੈਨੂੰ ਸਮਾਨ ਨਾ ਭੇਜਿਆ ਜਾਵੇ ਅਤੇ ਉਹ ਮੇਰੇ ਪੈਸੇ ਜਿਹੜੇ ਉਸ ਸਮੇਂ ਤੁਰੰਤ ਕੱਟੇ ਗਏ ਸਨ ਉਹ ਮੈਨੂੰ ਕਿਰਪਾ ਕਰਕੇ ਵਾਪਸ ਕੀਤੇ ਜਾਣ ਅਤੇ ਮੈਨੂੰ ਇਹ ਦੱਸ ਸਕਦੇ ਹੋ ਕਿ ਕਿਸ ਸਮੇਂ ਉਹ ਮੈਨੂੰ ਪੈਸੇ ਮੇਰੇ ਵਾਪਸ ਮਿਲਣਗੇ